ਸਾਡੇ ਭਾਰਤ ਨੂੰ ਤਿਉਹਾਰਾਂ ਦਾ ਹੀ ਧਾਰਮਿਕ ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਹਰ ਤਿਉਹਾਰ ਨੂੰ ਬਹੁਤ ਹੀ ਉਤਸੁਕਤਾ ਨਾਲ ਅਤੇ ਅ ਸਮੁਕਤਾ ਨਾਲ ਮਨਾਇਆ ਜਾਂਦਾ ਹੈ ਤਿਉਹਾਰਾਂ ਦੀ ਦੇਖ ਰੇਖ ਇਹ ਹੁੰਦੀ ਹੈ ਕਿ ਧਾਰਮਿਕ ਮੌਕਿਆਂ 'ਤੇ ਜਿਵੇਂ ਗਣੇਸ਼ ਚਤੁਰਥੀ ਹੈ ਗਨੇਸ਼ ਚਤੁਰਥੀ 'ਤੇ ਅਸੀਂ ਮਿੱਟੀ ਘਰ ਲਿਆ ਕੇ ਖੁਦ ਮਿੱਟੀ ਦੀ ਮੂਰਤ ਬਣਾਉਂਦੇ ਹਾਂ ਮੂਰਤ ਬਣਾ ਕੇ ਉਹਨਾਂ ਦੇ ਵਿੱਚ ਰੰਗ ਭਰ ਕੇ ਉਹਨਾਂ ਨੂੰ ਮਤਲਬ ਮਿੱਟੀ ਨੂੰ ਹੀ ਗਣੇਸ਼ ਜੀ ਦਾ ਰੂਪ ਦਿੰਦੇ ਹਾਂ ਉਹਨਾਂ ਨਾਲ ਉਹਨਾਂ ਦੇ ਮੁਸ਼ਕ ਰਾਜ ਵੀ ਬਿਠਾਉਂਦੇ ਹਾਂ ਫਿਰ ਉਹਨਾਂ ਦੀ ਪੂਜਾ ਕਰਦੇ ਹਾਂ ਫਿਰ ਕਾਫ਼ੀ ਤਿਉਹਾਰ ਇਹੋ ਜਿਹੇ ਹੁੰਦੇ ਨੇ ਕਿ ਜਿੰਨ੍ਹਾਂ ਦੇ ਮੂਰਤਾਂ ਦੀ ਮੂਰਤੀਆਂ ਦੀ ਲੋੜ ਪੈਂਦੀ ਹੈ ਕਿ ਜਿਵੇਂ ਦਿਵਾਲੀ ਹੈ ਦਿਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ ਇਸ ਦਿਨ ਲੋਕ ਬਹੁਤ ਖੁਸ਼ੀਆਂ ਮਨਾਉਂਦੇ ਨੇ ਘਰਾਂ ਵਿੱਚ ਦੀਪ ਜਲਾਉਂਦੇ ਨੇ ਜਿਹੜੇ ਦੀਪ ਹੁੰਦੇ ਨੇ ਉਹ ਵੀ ਮਿੱਟੀ ਨਾਲ ਬਣਦੇ ਨੇ ਅਸੀਂ ਮਿੱਟੀ ਨਾਲ ਦੀਪਕ ਬਣਾ ਲੈਂਦੇ ਹਾਂ ਬਣਾ ਕੇ ਅਸੀਂ ਉਹਨਾਂ ਨੂੰ ਰਾਤ ਨੂੰ ਉਹਨਾਂ ਨੂੰ ਬਣਾ ਕੇ ਸੁਕਾਉਂਦੇ ਹਾਂ ਸੁਕਾ ਕੇ ਉਹਨਾਂ ਵਿੱਚ ਰੰਗ ਭਰਦੇ ਹਾਂ ਰੰਗ ਭਰ ਕੇ ਫਿਰ ਉਹਨਾਂ ਨੂੰ ਸੁਕਾ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਪੱਕੇ ਕਰਕੇ ਤਿਆਰ ਕਰਕੇ ਫਿਰ ਅਸੀਂ ਉਹਨਾਂ ਨੂੰ ਰਾਤ ਪਾਣੀ ਵਿੱਚ ਭਿਗੋ ਕੇ ਰੱਖਦੇ ਹਾਂ ਤਾਂ ਕਿ ਉਹ ਹੋਰ ਪੱਕੇ ਹੋ ਜਾਣ ਫਿਰ ਉਹਨਾਂ ਨੂੰ ਪਾਣੀ 'ਚ ਕੱਢ ਕੇ ਸੁਕਾ ਕੇ ਉਹਨਾਂ 'ਚ ਤੇਲ ਪਾ ਕੇ ਉਹਨਾਂ ਨੂੰ ਮਤਲਬ ਦਿਵਾਲੀ ਦਿਵਾਲੀ ਰਾਤ ਅਸੀਂ ਦੀਵੇ ਜਗਾਉਂਦੇ ਹਾਂ ਜਿਹਦੇ ਨਾਲ ਕਿ ਦਿਵਾਲੀ ਦੀ ਰਾਤ ਜਗ ਮਗਾਉਂਦੀ ਹੋਈ ਦਿਖਦੀ ਹੈ ਹੋਰ ਵੀ ਕਈ ਤਿਉਹਾਰ ਨੇ ਜਿੰਨ੍ਹਾਂ ਵਿੱਚ ਅਸੀਂ ਮਿੱਟੀ ਦਾ ਪ੍ਰਬੰਧ ਯੂਜ ਕਰਦੇ ਹੀ ਕਰਦੇ ਹਾਂ ਮਿੱਟੀ ਬਿਨ੍ਹਾਂ ਕੋਈ ਵੀ ਤਿਉਹਾਰ ਪੂਰਾ ਨਹੀਂ ਹੁੰਦਾ ਅਸੀਂ ਤਿਉਹਾਰਾਂ 'ਤੇ ਮਿੱਟੀ ਦੀਆਂ ਮੂਰਤੀਆਂ ਬਣਾ ਲੈਂਦੇ ਹਾਂ ਅਤੇ ਅਸੀਂ ਖੁਦ ਵੀ ਬਣਾਈਆਂ ਹੋਈਆਂ ਨੇ ਉਹਨਾਂ ਵਿੱਚ ਕਲਰ ਕਰਕੇ ਉਹਨਾਂ ਨੂੰ ਰੰਗ ਰੰਗ ਭਰ ਕੇ ਉਹਨਾਂ ਨੂੰ ਉਹਨਾਂ ਨੂੰ ਰੰਗ ਬਰੰਗੀਆਂ ਬਣਾ ਕੇ ਅਸੀਂ ਤਿਉਹਾਰ ਮਨਾਉਂਦੇ ਹਾਂ